ਜ਼ਿੰਦਗੀ ਦੇ ਅੰਦਰ ਕਿਸੇ ਵੀ ਵਿਅਕਤੀ ਦੀ ਉਸਤਤ ਕਰਨ ਦੇ ਲਈ ਕਾਵਿ ਰੂਪ ਦੇ ਵਿੱਚ ਲਿਖਿਆ ਜਾ ਸਕਦਾ ਹੈ ਕਾਵਿ ਰੂਪ ਨੂੰ ਜਦੋਂ ਅਸੀਂ ਕਵਿਤਾ ਦਾ ਰੂਪ ਦਿੰਦੇ ਹਾਂ ਤਾਂ ਉਸਨੂੰ ਸਮਾਜ ਦੇ ਅੰਦਰ ਬਹੁਤ ਹੀ ਪਸੰਦ ਕੀਤਾ ਜਾਂਦਾ ਹੈ ਅਤੇ ਇਹ ਕਵਿਤਾ ਸਾਡੀ ਰੂਹ ਨੂੰ ਬਹੁਤ ਸਕੂਨ ਦਿੰਦੀ ਹੈ ਅਤੇ ਜਿਸ ਨੂੰ ਮੇਰੇ ਬਹੁਤ ਹੀ ਪਿਆਰੇ ਮਿੱਤਰ ਨੇ ਪੜ੍ਹ ਕੇ ਸੁਣ ਕੇ ਪਸੰਦ ਕੀਤਾ ਹੈ